ਹਾਂਜੀ ਹਾਂਜੀ ਅਤੇ ਕਾਹਦੀਆਂ ਧਮਕੀਆਂ ਨੇ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਤੁਸੀਂ ਆਪ ਤਾਂ ਨਹੀਂ ਕਦੇ ਪਰਸਨਲ ਮਿਲ ਕੇ ਆਏ ਅੱਛਾ ਅਤੇ ਤੁਹਾਡੀ ਤੁਹਾਨੂੰ ਕਿਸੇ 'ਤੇ ਸ਼ੱਕ ਹੈਗਾ ਜੀ

ਤੁਹਾਨੂੰ ਥਾਣੇ ਆ ਕੇ ਇੱਕ ਵਾਰੀ ਕੰਪਲੇਟ ਉਹ ਲਿਖਾਉਣੀ ਪਵੇਗੀ ਰਿਟਨ 'ਚ ਰਿਪੋਰਟ ਹਾਂਜੀ ਠੀਕ ਹੈ ਜੀ ਅੱਛਾ ਇੱਕ ਜਦੋਂ ਆਏ ਤੁਸੀਂ ਆਪਣਾ ਆਈ ਡੀ ਪਰੂਫ ਲਿਆਇਓ ਜੀ ਨਾਲ ਅੱਛਾ ਜੀ ਕੋਈ ਵੀ ਦਿੱਕਤ ਆਵੇ ਤੁਸੀਂ ਇਸ ਨੰਬਰ 'ਤੇ ਕਦੋਂ ਵੀ ਫੋਨ ਕਰ ਸਕਦੇ ਹੋ ਠੀਕ ਹੈ ਚੱਲੋ ਠੀਕ ਹੈ ਜੀ ਤੁਸੀਂ ਕੱਲ੍ਹ ਨੂੰ ਆ ਜਿਓ ਅਤੇ ਬਾਕੀ ਆਪਾਂ ਦੇਖਦੇ